ਗਰਮੀਆਂ ਵਿੱਚ ਲਗਾਏ ਪੌਦੇ ਅਤੇ ਗ ਸਰਦੀਆਂ ਵਿੱਚ ਲਗਾਏ ਪੌਦੇ ਅਲੱਗ ਅਲੱਗ ਤਰ੍ਹਾਂ ਦੇ ਪੌਦੇ ਹੁੰਦੇ ਹਨ ਇਹਨਾਂ ਪੌਦਿਆਂ ਦੇ ਵਿੱਚ ਕੱਚੇ ਪੌਦੇ ਪੱਕੇ ਪੌਦੇ ਔਰਨਾਮੈਂਟਲ ਪੌਦੇ ਅਤੇ ਆਮ ਕਰਕੇ ਫਲਾਂ ਵਾਲੇ ਪੌਦੇ ਵੀ ਹੁੰਦੇ ਨੇ ਫਲਾਂ ਵਾਲੇ ਪੌਦੇ ਮੌਸਮ ਦੇ ਮੁਤਾਬਿਕ ਲੱਗਦੇ ਨੇ ਕੱਚੇ ਪੌਦੇ ਵੀ ਮੌਸਮ ਦੇ ਮੁਤਾਬਿਕ ਹੀ ਚੱਲਦੇ ਨੇ ਕਈ ਮੌਸਮਾਂ ਦੇ ਵਿੱਚ ਕੱਚੇ ਪੌਦੇ ਆਪਦਾ ਛੇ ਮਹੀਨੇ ਤੋਂ ਦਾ ਸੀਜਨ ਪੂਰਾ ਕਰਨ ਤੋਂ ਬਾਅਦ ਮੌਸਮ ਪੂਰਾ ਕਰਨ ਤੋਂ ਬਾਅਦ ਉਹ ਪੌਦੇ ਮਰ ਜਾਂਦੇ ਨੇ ਉਸ ਤੋਂ ਬਾਅਦ ਕੱਚੇ ਪੌਦੇ ਦੂਸਰੇ ਮੌਸਮ ਦੇ ਹਿਸਾਬ ਨਾਲ ਲਗਾਏ ਜਾਂਦੇ ਨੇ ਇਸ ਤਰ੍ਹਾਂ ਅਲੱਗ ਅਲੱਗ ਮੌਸਮ ਵਿੱਚ ਕੱਚੇ ਪੌਦੇ ਪੱਕੇ ਪੌਦੇ ਅਲੱਗ ਅਲੱਗ ਮੌਸਮ ਅਲੱਗ ਅਲੱਗ ਤਰੀਕੇ ਨਾਲ ਅਲੱਗ ਅਲੱਗ ਮੌਸਮ ਨਾਲ ਅਲੱਗ ਅਲੱਗ ਜਗ੍ਹਾ ਦੇ ਮੁਤਾਬਿਕ ਹੀ ਲੱਗਦੇ ਨੇ ਇਹਨਾਂ ਪੌਦਿਆਂ ਦੇ ਵਿੱਚ ਆਮ ਕਰਕੇ ਫੁੱਲਾਂ ਵਾਲੇ ਪੌਦੇ ਉਹ ਪੌਦਿਆਂ ਨੂੰ ਲਗਾਉਣ ਵਾਸਤੇ ਜਿਸ ਤਰ੍ਹਾਂ ਸਰਦੀਆਂ ਦਾ ਸੀਜ਼ਨ ਜਾਣ ਤੋਂ ਬਾਅਦ ਅਤੇ ਗਰਮੀਆਂ ਦਾ ਸੀਜ਼ਨ ਆਉਣ ਤੋਂ ਪਹਿਲਾਂ ਬਹਾਰ ਦਾ ਜਿਹੜਾ ਮੌਸਮ ਉਹਨੂੰ ਕਿਹਾ ਜਾਂਦਾ ਉਸ ਮੌਸਮ ਦੇ ਵਿੱਚ ਵਧੀਆ ਫੁੱਲਾਂ ਵਾਲੇ ਪੌਦੇ ਲਗਾਏ ਜਾਂਦੇ ਨੇ ਉਹ ਕੱਚੇ ਪੌਦੇ ਹੁੰਦੇ ਨੇ ਉਹ ਇਸੇ ਕਰਕੇ ਤਿੰਨ ਮਹੀਨੇ ਜਾਂ ਚਾਰ ਮਹੀਨੇ ਚਲਦੇ ਨੇ ਅਤੇ ਫਲਾਂ ਵਾਲੇ ਪੌਦੇ ਅਤੇ ਪੱਕੇ ਪੌਦੇ ਜਿਸ ਤਰ੍ਹਾਂ ਟਾਹਲੀ ਨਿੰਮ ਅਮਰੂਦ ਜਾਮਣ ਅੰਬ ਕਿੱਕਰ ਅਤੇ ਹੋਰ ਪੌਦੇ ਵੀ ਹੈਗੇ ਨੇ ਜਿਹੜੇ ਉਹ ਕਿਸੇ ਵੀ ਮੌਸਮ ਦੇ ਵਿੱਚ ਅਤੇ ਕਿਸੇ ਵੀ ਸਟੇਟ ਦੇ ਵਿੱਚ ਕਿਹੋ ਜਿਹੇ ਵੀ ਮੌਸਮ ਦੇ ਮੁਤਾਬਿਕ ਉਹ ਚੱਲ ਜਾਂਦੇ ਨੇ ਹਾਲਾਂਕਿ ਉਹਨਾਂ ਦੇ ਉਹਨਾਂ ਦਾ ਮੌਸਮ ਦੇ ਨਾਲ ਨਾਲ ਥੋੜਾ ਬਹੁਤ ਫਰਕ ਇਸ ਤਰ੍ਹਾਂ ਦਾ ਪੈਂਦਾ ਵੀ ਉਹਦੇ ਪੱਤੇ ਵੀ ਝੜਦੇ ਨੇ ਫਲ ਵੀ ਇਸ ਤਰ੍ਹਾਂ ਕਈ ਵਾਰੀ ਉਸ ਮੌਸਮ ਵਿੱਚ ਨਹੀਂ ਲੱਗਦੇ ਜਿਹੜਾ ਆਮ ਮਤਲਬ ਦੋ ਮਹੀਨਿਆਂ ਦਾ ਮੌਸਮ ਹੈਗਾ ਉਹ 'ਚ ਮੌਸਮ ਦੇ ਵਿੱਚ ਨਹੀਂ ਲੱਗਦੇ ਬਰ ਪਰ ਪਰ ਅਗਲੇ ਮੌਸਮ ਵਿਚ ਚਾਰ ਮਹੀਨੇ ਛੇ ਮਹੀਨੇ ਪੂਰਾ ਉਹ ਫਲ ਦਿੰਦੇ ਨੇ ਇਹ ਫਲ ਇਸ ਤਰ੍ਹਾਂ ਦਾ ਹੁੰਦਾ ਵੀ ਉਹ ਜਿਹੜੇ ਮੌਸਮ ਦੇ ਵਿੱਚ ਮਤਲਬ ਉਹ ਫਲ ਪਲਦਾ ਉੱਥੇ ਉੱਥੇ ਹੀ ਉਹ ਪੌ ਪੌਦਾ ਲਗਾਇਆ ਜਾਂਦਾ ਪਰੰਤੂ ਇਸ ਪ ਇਸ ਪੌਦੇ ਨੂੰ ਫ਼ਲਾ ਵਾਲੇ ਪੌਦੇ ਨੂੰ ਜਿਵੇਂ ਅਮਰੂਦ ਜਾਮਣ ਅੰਬ ਇਹਨੂੰ ਲਗਾਇਆ ਤਾਂ ਸਾਰੇ ਕਿਤੇ ਜਾ ਸਕਦਾ ਪਰ ਉਹ ਫਲ ਦੇਣਾ ਜਾਂ ਨਾ ਦੇਣਾ ਉਹ ਮੌਸਮ ਦੇ ਮੁਤਾਬਿਕ ਹੁੰਦਾ ਜਿਸ ਤਰ੍ਹਾਂ ਹੁਣ ਅ ਜਿਹੜਾ ਹੈਗਾ ਅਮਰੂਦ ਹੈ ਅਤੇ ਜਾਮਣ ਹੈ ਅਤੇ ਅੰਬ ਹੈ ਇਹ ਪੰਜਾਬ ਦੇ ਵਿੱਚ ਹਿਮਾਚਲ ਦੇ ਵਿੱਚ ਦੋਨਾਂ ਆਪਸ ਮੀ ਆਪਸੀ ਜਿਹੜੇ ਜਿੱਥੇ ਸਾਂਝਾ ਜਿਹਾ ਏਰੀਆ ਉੱਥੇ ਇਹ ਲੱਗ ਜਾਂਦਾ ਪਰ ਇਹ ਇਹ ਜਿਹੜਾ ਅੰਬ ਹੈ ਉਹ ਰਾਜਸਥਾਨ ਦੇ ਵਿੱਚ ਨਹੀਂ ਹੁੰਦਾ ਸੇਬ ਹੈ ਸੇਬ ਜੰਮੂ ਕਸ਼ਮੀਰ 'ਚ ਹੁੰਦਾ ਪੰਜਾਬ 'ਚ ਨਹੀਂ ਹੁੰਦਾ ਕੇਰਲਾ 'ਚ ਨਹੀਂ ਹੁੰਦਾ ਰਾਜਸਥਾਨ 'ਚ ਨਹੀਂ ਹੁੰਦਾ ਇਸੇ ਤਰ੍ਹਾਂ ਜੇ ਤੁਸੀਂ ਗੱਲ ਕਰੋ ਨਾਰੀਅਲ ਦੀ ਨਾਰੀਅਲ ਕੇਰਲਾ ਵਿੱਚ ਹੁੰਦਾ ਪੰਜਾਬ 'ਚ ਨਹੀਂ ਹੁੰਦਾ ਕੇਲਾ ਪੰਜਾਬ 'ਚ ਨਹੀਂ ਹੁੰਦਾ ਪਰ ਕੇਰਲਾ 'ਚ ਹੁੰਦਾ ਇਸ ਤਰ੍ਹਾਂ ਇਹ ਅਲੱਗ ਅਲੱਗ ਕਿਸਮ ਦੇ ਜਿਹੜੇ ਪੌਦੇ ਨੇ ਅਤੇ ਅਲੱਗ ਅਲੱਗ ਕਿਸਮ ਦੇ ਜਿਹੜੇ ਆ ਕੱਚੇ ਪੌਦੇ ਪੱਕੇ ਪੌਦੇ ਆਪੋ ਆਪੋ ਆਪਣੇ ਮੌਸਮ ਨਾਲ ਆਪੋ ਆਪਣੇ ਜਿਹੜੇ ਹੈਗੇ ਨੇ ਧਰਤੀ ਦੇ ਮੁਤਾਬਿਕ ਇਹ ਉਗਾਏ ਜਾਂਦੇ ਹਨ ਧੰਨਵਾਦ